ਭਾਰਤ ਦੇ ਸਭ ਤੋਂ ਮਹੱਤਵਪੂਰਨ ਜਿਹੜੇ ਤਿਉਹਾਰ ਨੇ ਪੰਦਰਾਂ ਅਗਸਤ ਹੋ ਗਿਆ ਦਿਵਾਲੀ ਦੁਸ਼ਹਿਰਾ ਅਤੇ ਲੋਹੜੀ ਪੰਦਰਾਂ ਅਗਸਤ ਵਾਲੇ ਦਿਨ ਭਾਰਤ ਆ ਜਿਹੜਾ ਉਹ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦ ਹੋਇਆ ਅਤੇ ਉਹ ਬੜੇ ਉਸ ਦਿਨ ਬੜੀ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਕਿ ਸਾਡਾ ਜਿਹੜਾ ਦੇਸ਼ ਆ ਉਹ ਇੰਡੀਪੈਂਡੈਂਟ ਹੋ ਗਿਆ ਉਸ ਤੋਂ ਬਾਅਦ ਪੰਦਰਾਂ ਅਗਸਤ ਨੂੰ ਹੀ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਜਾਂਦਾ ਪਰੇਡ ਹੁੰਦੀ ਹੈ ਅਤੇ ਨਾਲ ਹੀ ਜਿਸ ਤਰ੍ਹਾਂ ਅਸੀਂ ਦਿਵਾਲੀ ਦੀ ਗੱਲ ਕਰਦੇ ਹਾਂ ਇਹ ਵੀ ਭਾਰਤ ਦਾ ਮਹੱਤਵਪੂਰਨ ਤਿਉਹਾਰ ਆ ਕਿਉਂਕਿ ਹਿੰਦੂਆਂ ਅਤੇ ਸਿੱਖਾਂ ਦਾ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ ਅਤੇ ਹਿੰਦੂ ਇਸ ਨੂੰ ਰਾਮ ਚੰਦਰ ਜੀ ਦੇ ਬਨਵਾਸ ਕੱਟਣ ਤੋਂ ਬਾਅਦ ਘਰ ਆਉਣ ਦੀ ਖੁਸ਼ੀ 'ਚ ਮਨਾਉਂਦੇ ਨੇ ਜਿਹੜੇ ਸਿੱਖ ਨੇ ਉਹਨਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਚੋਂ ਬਵੰਜਾ ਕਿਲ੍ਹਿਆਂ ਨੂੰ ਜਦੋਂ ਬਾਹਰ ਲੈ ਕੇ ਆਉਂਦੇ ਨੇ ਤੋ ਇਸ ਖੁਸ਼ੀ ਦੇ ਵਿੱਚ ਸਿੱਖ ਜਿਹੜਾ ਇਹ ਤਿਉਹਾਰ ਮਨਾਉਂਦੇ ਨੇ ਅਤੇ ਇਸੇ ਤਰ੍ਹਾਂ ਹੀ ਹੈ ਦੁਸ਼ਹਿਰਾ ਹੈ ਦੁਸ਼ਹਿਰੇ ਵਾਲੇ ਦਿਨ ਜਿਸ ਤਰ੍ਹਾਂ ਹੈ ਕਿ ਰਾਵਣ ਨੂੰ ਨੂੰ ਬਦੀ ਦਾ ਪ੍ਰਤੀਕ ਮੰਨਦੇ ਹੋਏ ਰਾਮ ਨੇ ਇਹਨਾਂ 'ਤੇ ਜਿੱਤ ਪ੍ਰਾਪਤ ਕੀਤੀ ਉਸ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਅਤੇ ਇਸੇ ਤਰ੍ਹਾਂ ਹੀ ਲੋਹੜੀ ਇੱਕ ਮਹੱਤਵਪੂਰਨ ਤਿਉਹਾਰ ਆ ਲੋਹੜੀ ਵੀ ਵੱਖ ਵੱਖ ਸਟੇਟ ਦੇ ਵਿੱਚ ਹੈ ਨਾ ਵੱਖ ਵੱਖ ਨਾਵਾਂ ਦੇ ਨਾਲ ਮਨਾਈ ਜਾਂਦੀ ਆ ਮੈਂ ਪੰਜਾਬ ਨੂੰ ਬਿਲੋਂਗ ਕਰਦੀ ਹਾਂ ਅਤੇ ਪੰਜਾਬ ਦੇ ਵਿੱਚ ਹਰ ਸਾਲ ਇਹ ਤੇਰਾਂ ਜਨਵਰੀ ਨੂੰ ਵੈਸੇ ਮਨਾਇਆ ਜਾਂਦਾ ਸਾਰੇ ਪੂਰੇ ਭਾਰਤ ਦੇ ਵਿੱਚ ਪਰ ਲੋਹੜੀ ਆ ਜਿਹੜੀ ਉਹ ਇੱਕ ਛੋਟੇ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਵਿਆਹ ਦੀ ਖੁਸ਼ੀ ਵਿੱਚ ਅਤੇ ਵੱਖ ਵੱਖ ਸਟੇਟਾਂ ਦੇ ਵਿੱਚ ਵੱਖ ਵੱਖ ਨਾਵਾਂ ਦੇ ਨਾਲ ਆ ਜਿਹੜਾ ਇਹ ਮਨਾਈ ਜਾਂਦੀ